ਹੈਲੋ ਹੈਲੋ ਹਾਂਜੀ ਮੈਂ ਦੀਪਿਕਾ ਗੱਲ ਕਰਦੀ ਪਈ ਹਾਂ ਹਾਂਜੀ ਨਮਸਕਾਰ ਹਾਂਜੀ ਹੋਰ ਕੀ ਹਾਲ ਚਾਲ ਹਾਂਜੀ ਵਧੀਆ ਹੋਰ ਮੈਂ ਪੁੱਛਣਾ ਚਾਹੁੰਦੀ ਕਿ ਇਹ ਤੁਹਾਡਾ ਦੁਕਾਨ ਦਾ ਕੀ ਹਿਸਾਬ ਕਿਤਾਬ ਹੈ ਕੀ ਮਤਲਬ ਕਿਸ ਤਰੀਕੇ ਦੀ ਕਮਾਈ ਹੋਣਡੀ ਹੈ ਅੱਛਾ ਅੱਛਾ ਹਾਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਹੋਰ ਹਾਂਜੀ ਮੇਰਾ ਅ ਜਿਹੜਾ ਮੇਰਾ ਕਰਿਆਨੇ ਦੀ ਸ਼ੋਪ ਹੈ ਸਟੋਰ ਹੈ ਹਾਂਜੀ ਮੇਰਾ ਵੀ ਠੀਕ ਠਾਕ ਨਿਕਲ ਆਉਂਦਾ ਵਿੱਚ ਨਾਲ ਕਿਉਂਕਿ ਮੈਂ ਸਾਡਾ ਉਹ ਵੀ ਹੈ ਨਾ ਵਿੱਚ ਸਬਜ਼ੀਆਂ ਦਾ ਵੀ ਕੰਮ ਹੈ ਵਿੱਚ ਵਿੱਚ ਨਾਲ ਹੀ ਸਾਡਾ ਕਰਿਆਨੇ ਦੀ ਸ਼ੋਪ ਹੈ ਤੇ ਇਸ ਕਰਕੇ ਸਾਡਾ ਠੀਕ ਠਾਕ ਨਿਕਲ ਆਉਂਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਵਧੀਆ ਹੋਣ ਡਿਆ ਆ ਹਾਂਜੀ ਤੁਸੀਂ ਹੋਰ ਕੁਛ ਟਰਾਈ ਕਰ ਲਓ ਜੇ ਤੁਹਾਡੀ ਕਮਾਈ ਨਹੀਂ ਸੈੱਟ ਬਹਿੰਡੀ ਤਾਂ ਅੱਛਾ ਅੱਛਾ ਠੀਕ ਹੈ ਠੀਕ ਹੈ ਮਤਲਬ ਹਾਂਜੀ ਠੀਕ ਹੈ ਜੀ ਹਾਂਜੀ ਉਹ ਤਾਂ ਸਹੀ ਹੈ ਹਾਂਜੀ ਹਾਂਜੀ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਹੋਰ ਹਾਂਜੀ ਠੀਕ ਠੀਕ ਹੈ ਓਕੇ ਓਕੇ ਜੀ